ਔਰਤਾਂ ਵਿੱਚ ਮਾਹਵਾਰੀ ਦਾ ਆਉਣਾ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਕਿ ਹਰ ਔਰਤ ਨੂੰ ਹਰ ਮਹੀਨੇ ਬਾਅਦ ਆਉਂਦੀ ਹੈ ਸਾਡੇ ਸੱਭਿਆਚਾਰ ਵਿੱਚ ਔਰਤਾਂ ਦੀ ਮਾਹਵਾਰੀ ਦਾ ਇਲਾਜ ਵੱਖ ਵੱਖ ਢੰਗ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜਿਵੇਂ ਕਿ ਔਰਤਾਂ ਨੂੰ ਮੈਡੀਕਲ ਕੈਂਪਾਂ ਵਿੱਚ ਮਾਹਵਾਰੀ ਦੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਸੰਬੰਧੀ ਸਰਕਾਰ ਵੱਲੋਂ ਵੀ ਸਮੇਂ ਸਮੇਂ ਸਿਰ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਜਿਸ ਵਿੱਚ ਔਰਤਾਂ ਦੇ ਰੋਗਾਂ ਸੰਬੰਧੀ ਮਾਹਰ ਡਾਕਟਰ ਇਹਨਾਂ ਕੈਂਪਾਂ ਵਿੱਚ ਆਉਂਦੇ ਹਨ ਜੋ ਕਿ ਔਰਤਾਂ ਨੂੰ ਭਰਪੂਰ ਜਾਣਕਾਰੀ ਦਿੰਦੇ ਹਨ ਇਸ ਤੋਂ ਇਲਾਵਾ ਯੂਟਿਊਬ ਚੈਨਲਾਂ ਅਤੇ ਹੋਰ ਸਮਾਜਿਕ ਸਾਈਟਾਂ ਉੱਤੇ ਵੀ ਔਰਤਾਂ ਸਮੇਂ ਸਮੇਂ ਸਿਰ ਜਾਣਕਾਰੀ ਲੈ ਸਕਦੀਆਂ ਹਨ ਇਹਨਾਂ ਤੋਂ ਬਿਨਾ ਕੁਝ ਹੋਰ ਘਰੇਲੂ ਨੁਸਖੇ ਵੀ ਨੇ ਜੋ ਕਿ ਮਾਹਵਾਰੀ ਦੌਰਾਨ ਬਹੁਤ ਵਧੀਆ ਸਾਬਤ ਹੁੰਦੇ ਨੇ ਜਿਵੇਂ ਕਿ ਔਰਤਾਂ ਨੂੰ ਇਹਨਾਂ ਸੰਬੰਧੀ ਦੱਸਿਆ ਜਾਂਦਾ ਹੈ ਕਿ ਚਾਹ ਕੌਫੀ ਦਾ ਸੇਵਨ ਘੱਟ ਕਰਨਾ ਸਿਗਰਟ ਬੀੜੀ ਤੰਬਾਕੂ ਸ਼ਰਾਬ ਆਤੀ ਆਦੀ ਦੀ ਵਰਤੋਂ ਨਾ ਕਰਨਾ ਹਫਤੇ ਵਿੱਚ ਘੱਟੋ ਘੱਟ ਪੰਜ ਦਿਨ ਤਿੰਨ ਤੀਹ ਮਿੰਟ ਵਾਸਤੇ ਕਸਰਤ ਕਰਨਾ ਇਸ ਨਾਲ ਕਮਰ ਦਰਦ ਅਤੇ ਮਾਹਵਾਰੀ ਦਾ ਦਰਦ ਠੀਕ ਕਰਨ ਵਿੱਚ ਸਹਾਇਤਾ ਮਿਲਦੀ ਹੈ ਖਾਣ ਵਿੱਚ ਅਜਿਹੀਆਂ ਵਸਤੂਆਂ ਦੀ ਵਰਤੋਂ ਕਰਨਾ ਜਿਨ੍ਹਾਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਰੇਸ਼ੇ ਹੋਣ ਕੁਝ ਪਦਾਰਥ ਅਜਿਹੇ ਹਨ ਜਿਨ੍ਹਾਂ ਵਿੱਚ ਚੀਨੀ ਅਤੇ ਸ਼ੱਕਰ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਅਜਿਹੇ ਪਦਾਰਥਾਂ ਤੋਂ ਬਚਣਾ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਾਪਤ ਕਰਨਾ ਮਾਹਵਾਰੀ ਦੌਰਾਨ ਔਰਤਾਂ ਲਈ ਸਾਡੇ ਸਮਾਜ ਵੱਲੋਂ ਕੁਝ ਧਾਰਮਿਕ ਅਤੇ ਸਾਇੰਸ ਨਾਲ ਸੰਬੰਧਿਤ ਕੁਝ ਨਿਯਮ ਬਣਾਏ ਗਏ ਹਨ ਪਰੰਤੂ ਕੁਝ ਔਰਤਾਂ ਇਹਨਾਂ ਦਾ ਪਾਲਣ ਕਰਦੀਆਂ ਹਨ ਪਰੰਤੂ ਕੁਝ ਇਹਨਾਂ ਨੂੰ ਅੰਧ ਵਿਸ਼ਵਾਸ ਨਾਲ ਜੋੜਦੀਆਂ ਹਨ ਜਿਵੇਂ ਕਿ ਕੁਝ ਲੋਕ ਇਸ ਮਾਹਵਾਰੀ ਦੌਰਾਨ ਇਸਤਰੀਆਂ ਨੂੰ ਅਸ਼ੁੱਧ ਸਮਝਦੇ ਹਨ ਅਤੇ ਕਈ ਰਾਜਾਂ ਵਿੱਚ ਤਾਂ ਇਹ ਵੀ ਵਹਿਮ ਹੈ ਕਿ ਇਸਤਰੀ ਨੂੰ ਮਾਹਵਾਰੀ ਦੇ ਸਮੇਂ ਦੌਰਾਨ ਪੂਜਾ ਵਿੱਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਹੁੰਦੀ ਪਰੰਤੂ ਇਹ ਨਿਰੇ ਹੀ ਵਹਿਮ ਹਨ ਇਸ ਸੰਬੰਧੀ ਸਾਡਾ ਸਮਾਜ ਬਹੁਤ ਜਾਗਰੂਕ ਹੈ ਉਨ੍ਹਾਂ ਨੂੰ ਪਤਾ ਹੈ ਕਿ ਸਮੇਂ ਸਮੇਂ ਸਿਰ ਸਾਡੇ ਸਰੀਰ ਦੀ ਸਫਾਈ ਕਿੱਦਾਂ ਰੱਖਣੀ ਹੈ ਜਿਵੇਂ ਕਿ ਖਾਣਾ ਖਾਣ ਤੋਂ ਪਹਿਲਾਂ ਕੁਰਲੀ ਕਰਨੀ ਅਤੇ ਖਾਣਾ ਖਾਣ ਤੋਂ ਬਾਅਦ ਬਰੱਸ਼ ਦਾਤਣ ਕਰਨਾ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਸਮੇਂ ਸਮੇਂ ਸਿਰ ਰੋਗਾਂ ਸੰਬੰਧੀ ਟੀਕੇ ਲਵਾਉਣਾ ਡੇਂਗੂ ਤੋਂ ਬਚਾਅ ਸੰਬੰਧੀ ਜਾਗਰੂਕ ਹੋਣਾ ਲੋੜ ਪੈਣ 'ਤੇ ਮੂੰਹ 'ਤੇ ਮਾਸਕ ਦੀ ਵਰਤੋਂ ਕਰਨਾ ਇਹਨਾਂ ਸੰਬੰਧੀ ਅੱਜ ਕੱਲ੍ਹ ਸਾਡਾ ਸਮਾਜ ਬਹੁਤ ਜਾਗਰੂਕ ਹੈ